ਪੰਜਾਬ ਵਿੱਚ ਵੱਖ ਵੱਖ ਧਰਮਾਂ ਅਤੇ ਧਰਮਾਂ ਜਾਤੀਆਂ ਦੇ ਲੋਕ ਰਹਿੰਦੇ ਹਨ ਜਿਹਨਾਂ ਦੇ ਵੱਖ ਵੱਖ ਤਿਉਹਾਰ ਇਹਨਾਂ ਦੇ ਵੱਖ ਵੱਖ ਤਿਉਹਾਰ ਅਤੇ ਨਾਚ ਹਨ ਲੋਕ ਨਾਚ ਹਨ ਪਰ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ ਮੰਨਿਆ ਜਾਂਦਾ ਜੋ ਕਿ ਪੰਜਾਬੀਆਂ ਦੇ ਪ੍ਰਸਿੱਧ ਲੋਕ ਨਾਚ ਹਨ ਗਿੱਧਾ ਕੁੜੀਆਂ ਦਾ ਪ੍ਰਸਿੱਧ ਲੋਕ ਨਾਚ ਹੈ ਜਦਕਿ ਭੰਗੜਾ ਮੁੰਡਿਆਂ ਦਾ ਪ੍ਰਸਿੱਧ ਲੋਕ ਨਾਚ ਹੈ ਪ੍ਰੰਤੂ ਸਾਡੀ ਅੱਜ ਦੀ ਪੀੜ੍ਹੀ ਇਸ ਸਭ ਨੂੰ ਭੁੱਲ ਗਈ ਹੈ ਅੱਜ ਕੱਲ੍ਹ ਦੀ ਯੂਥ ਅੱਜ ਕੱਲ੍ਹ ਦਾ ਯੂਥ ਜ਼ਿਆਦਾਤਰ ਵੈਸਟਰਨ ਸੱਭਿਆਚਾਰ ਵੱਲ ਜਾ ਰਿਹਾ ਹੈ ਮਤਲਬ ਕਿ ਉਹਨਾਂ ਉਹਨਾਂ ਨੂੰ ਬਾਹਰੀ ਸੱਭਿਆਚਾਰ ਬਹੁਤ ਪਸੰਦ ਹੈ ਉਹ ਬਾਹਰ ਰਹਿ ਕੇ ਪੱਬਾਂ ਵਿੱਚ ਜਾ ਕੇ ਡਾਂਸ ਕਰਨਾ ਬਹੁਤ ਪਸੰਦ ਕਰਦੇ ਹਨ ਪਰ ਸਾਡਾ ਆਪਣਾ ਅਸਲੀ ਲੋਕ ਨਾਚ ਭੰਗੜਾ ਅਤੇ ਗਿੱਧਾ ਹੈ ਜਿਸਨੂੰ ਸੁਰੱਖਿਅਤ ਕਰਨਾ ਸਾਡੀ ਜ਼ਿੰਮੇਵਾਰੀ ਹੈ ਇਸ ਲਈ ਵ ਇਸ ਲਈ ਸਾਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਆਪਣੇ ਪੱਧਰ 'ਤੇ ਯੂਥ ਫੈਸਟੀਵਲ ਕਰਵਾਏ ਜਾਣ ਲੋਕ ਆ ਲੋਕ ਸੱਭਿਆਚਾਰਿਕ ਮੇਲੇ ਕਰਵਾਏ ਜਾਣ ਜਿਸ ਵਿੱਚ ਸਾਡੇ ਸੱਭਿਆਚਾਰ ਨੂੰ ਜਿਸ ਵਿੱਚ ਸਾਡੇ ਸੱਭਿਆਚਾਰ ਨੂੰ ਰੀਪ੍ਰਜੈਂਟ ਕੀਤਾ ਜਾਵੇ ਦੱਸਿਆ ਜਾਵੇ ਕਿ ਸਾਡੇ ਲੋਕ ਨਾਚ ਕਿਹੜੇ ਕਿਹੜੇ ਹਨ ਸਾਡੇ ਬੱਚਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਨਾਚਾਂ ਬਾਰੇ ਦੱਸਿਆ ਜਾਵੇ ਪੰਜਾਬੀ ਲੋਕ ਨਾਚ ਬਹੁਤ ਸਾਰੇ ਹਨ ਜਿਵੇਂ ਕਿ ਭੰਗੜਾ ਗਿੱਧਾ ਮਲਵਈ ਗਿੱਧਾ ਲੁੱਡੀ ਇੱਦਾਂ ਦੇ ਬਹੁਤ ਸਾਰੇ ਲੋਕ ਨੱਚ ਹਨ ਪਰ ਗਿੱਧਾ ਅਤੇ ਭੰਗੜਾ ਪ੍ਰਸਿੱਧ ਹਨ ਬਹੁਤ ਸਾਰੇ ਮੁੰਡੇ ਕੁੜੀਆਂ ਇਸ ਗਿੱਧੇ ਅਤੇ ਭੰਗੜੇ ਰਾਹੀਂ ਆਪਣਾ ਆਪਣਾ ਘਰ ਵੀ ਚਲਾ ਰਹੇ ਹਨ ਮਲਵਈ ਗਿੱਧੇ ਵਾਲੇ ਮੁੰਡੇ ਬਹੁਤ ਹੀ ਮਸ਼ਹੂਰ ਹਨ ਜਿਹਨਾਂ ਨੂੰ ਵਿਆਹਾਂ ਵਿੱਚ ਵੀ ਲਿਜਾਇਆ ਜਾਂਦਾ ਹੈ ਜਿੱਥੇ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ਇਹ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਹੁਨਰ ਹੀ ਹੈ ਜਿਸ ਨੂੰ ਸਾਨੂੰ ਵਿਕਸਿਤ ਕਰਨਾ ਚਾਹੀਦਾ ਹੈ ਇਸ ਨੂੰ ਸੁਧਾਰਨ ਲਈ ਸਾਨੂੰ ਵੱਖ ਵੱਖ ਤਰ੍ਹਾਂ ਦੀ ਪ੍ਰਦਰਸ਼ਨ ਕੈਂਪਿੰਗ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਸ ਬਾਰੇ ਜਾਗਰਿਤ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਸੱਭਿਆਚਾਰ ਨੂੰ ਲੋਕ ਨਾਥਨ ਸੰਭਾਲ ਕੇ ਰੱਖਣ ਲਈ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਲੋਕ ਨਾਚ ਨੂੰ ਸੰਭਾਲ ਕੇ ਰੱਖਣਾ ਸਾਡੀ ਦੀ ਜ਼ਿੰਮੇਵਾਰੀ ਹੈ